ਹੈਲੋ ਹਾਂਜੀ ਗੋਪਾਲ ਸੂਹ ਬੋਲ ਰਹੋ ਹੋ ਹਾਂਜੀ ਇੱਕ ਔਡਰ ਕੀਤਾ ਸੀਗਾ ਅਤੇ ਔਡਰ ਨੂੰ ਹੋ ਗਿਆ ਕਾਫ਼ੀ ਟਾਇਮ ਅਤੇ ਡਿਲੀਵਰੀ ਦਾ ਟਾਇਮ ਸੀਗਾ ਜਿਹੜਾ ਉਹ ਤੋਂ ਵੀ ਲੇਟ ਹੋ ਗਿਆ ਅਤੇ ਪਹੁੰਚਿਆ ਨੀ ਹਾਲੇ ਤੱਕ ਬੰਦਾ ਮੇਰਾ ਔਡਰ ਨੰਬਰ ਸੀਗਾ ਪੰਜ ਚਾਰ ਇੱਕ ਛੇ ਦੋ ਤਿੰਨ ਪੰਜ ਇੱਕ ਵਜੇ ਔਡਰ ਕੀਤਾ ਸੀਗਾ ਜੀ ਅਤੇ ਡੇਢ ਘੰਟੇ ਦੇ ਵਿੱਚ ਵਿੱਚ ਡਿਲੀਵਰ ਹੋਣਾ ਸੀਗਾ ਅਤੇ ਹੁਣ ਤਾਂ ਦੋ ਘੰਟੇ ਤੋਂ ਵੀ ਉੱਪਰ ਟਾਇਮ ਹੋ ਚੁੱਕਿਆ ਅਤੇ ਮੈਂ ਚੈੱਕ ਕੀਤਾ ਸੀਗਾ ਕਿ ਜਿਹੜਾ ਬੰਦਾ ਡਿਲੀਵਰੀ 'ਤੇ ਆਉਣਾ ਸੀਗਾ ਉਹ ਮੇਰੇ ਹੈ ਤਾਂ ਨੇੜੇ ਤੇੜੇ ਹੀ ਘੁੰਮ ਰਿਹਾ ਮੈਂ ਫੋਨ ਕਰ ਰਿਹਾ ਤਾਂ ਉਹ ਫੋਨ ਵੀ ਨਹੀਂ ਚੱਕ ਰਹੇ ਤੁਸੀਂ ਜੇ ਉਹਨਾਂ ਨਾਲ ਗੱਲ ਕਰ ਸਕਦੇ ਹੋ ਉਹਨਾਂ ਨੂੰ ਮੈਸੇਜ ਲਗਾਓ ਕਿ ਹੈ ਨਾ ਕਿ ਮੇਰਾ ਫੋਨ ਚੱਕ ਲੈਣ ਜਾਂ ਤਾਂ ਤੁਸੀਂ ਆਪ ਖੁਦ ਗੱਲ ਕਰੋ ਜਾਂ ਮੈਨੂੰ ਨੰਬਰ ਦੇ ਦਿਓ ਜਿਸ ਚੀਜ਼ 'ਤੇ ਐਵੇਲੇਬਲ ਹੈ ਹਾਂਜੀ ਮੇਰਾ ਔਡਰ ਚੈ ਚੈੱਕ ਕਰ ਲਿਉ ਇੱਕ ਵਾਰ ਮੇਰਾ ਔਡਰ ਦੇ ਵਿੱਚ ਸੀਗਾ ਜੀ ਕੜਾਹੀ ਪਨੀਰ ਠੀਕ ਹੈ ਜੀ ਰਾਜਮਾਂਹ ਚਾਵਲ ਠੀਕ ਹੈ ਅਤੇ ਬਾਕੀ ਚਪਾਤੀਆ ਸੀਗੀਆਂ ਜੀ ਰੋਟੀ ਸੀਗੀ ਮਿੱਸੀ ਰੋਟੀਆਂ ਸੀਗੀਆਂ ਅਤੇ ਮਿਠਾਈਆਂ ਦੇ ਵਿੱਚ ਆਪਣਾ ਸਪੰਜੀ ਰਸਗੁੱਲਾ ਸੀਗਾ ਠੀਕ ਹੈ ਜੀ ਬਾਕੀ ਇੱਕ ਕੋਲਡ ਡਰਿੰਕ ਦੀ ਬੋਤਲ ਸੀਗੀ ਅਤੇ ਹਾਂਜੀ ਬੱਸ ਇਹ ਹੀ ਸੀਗਾ ਕਾਈ ਹੈ ਨਾ ਤੁਸੀਂ ਜਲਦੀ ਤੋਂ ਜਲਦੀ ਮਾੜਾ ਜਿਹਾ ਰਿਸਪੋਂਡ ਕਰੋ ਇਸ ਚੀਜ਼ ਦੇ ਉੱਤੇ ਥੈਂਕ ਯੂ